ਕਿਸਾਨ ਮੁੱਖ ਕਰਕੇ ਬਹੁਤ ਸਾਰੀਆਂ ਫਸਲਾਂ ਪ੍ਰਾਪਤ ਕਰਨਾ ਪਸੰਦ ਕਰਦੇ ਹਨ ਜਿਵੇਂ ਕਿ ਚ ਆਲੂ ਝੋਨਾ ਕਣਕ ਅਤੇ ਮੱਕੀ ਅ ਆਦਿ ਅਤੇ ਏ ਇਹ ਫ਼ਸਲਾਂ ਦਾ ਅੱਛਾ ਐਮ ਐਸ ਪੀ ਮਿਲਦਾ ਹੈ ਇਸ ਕਰਕੇ ਇਹ ਕ ਫਸਲਾਂ ਸਾਡੇ ਏਰੀਏ ਦੇ ਵਿੱਚ ਬਹੁਤ ਮੁੱਖ ਹਨ